ਮੈਂ ਬਸ ਯਾਤਰਾ ਅੱਜ ਤੱਕ ਆਪਣੇ ਐਕਸਪੀਰੀਅੰਸ ਅਤੇ ਆਪਣੇ ਘੁੰਮਣ ਫਿਰਨ ਲਈ ਕੀਤੀ ਹੈ ਨਵੀਆਂ ਜਗ੍ਹਾਵਾਂ ਦੇਖਣ ਲਈ ਕੀਤੀ ਹੈ ਜਾਂ ਆਪਣੇ ਕੰਮ ਲਈ ਸਾਈਟਸ ਲਈ ਕੰਸਟ੍ਰਕਸ਼ਨ ਲਈ ਵੀਜੇਟ ਲਈ ਕੀਤੀ ਹੈ ਉਸ ਤੋਂ ਇਲਾਵਾ ਕਿਸੇ ਹੋਰ ਕੰਮ ਲਈ ਨਹੀਂ ਕੀਤੀ ਹੈ